ਕੀ ਤੁਸੀਂ ਭਾਰਤ ਵਿੱਚ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਕ ਸੰਬੰਧਾਂ ਦਾ ਵਰਣਨ ਕਰ ਸਕਦੇ ਇਸਨੇ ਰਾਜ ਦੇ ਵਿਕਾਸ ਵਿੱਚ ਕਿਵੇਂ ਮਦਦ ਕੀਤੀ ਜਾਂ ਰੁਕਾਵਟ ਪਾਈ ਹੈ ਉਹਨੂੰ ਕੇਂਦਰ ਵਿੱਚ ਮੰਨ ਲਓ ਕੇਂਦਰ ਦੇ ਵਿੱਚ ਬੀ ਜੇ ਪੀ ਦੀ ਸਰਕਾਰ ਆ ਅਤੇ ਪੰਜਾਬ ਵਿੱਚ ਰ ਆਪ ਦੀ ਸਰਕਾਰ ਆ ਇਨ੍ਹਾਂ ਦੋਨਾਂ ਦੇ ਵਿੱਚ ਆਪਸ ਵਿੱਚ ਹੀ ਕੁਛ ਨਾ ਕੁਛ ਦਿੱਕਤਾਂ ਆਈਆਂ ਰਹਿੰਦੀਆਂ ਹਨ ਉੱਧਰ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਕਿ ਕਹਿੰਦੀ ਹੈ ਕਿ ਸਾਨੂੰ ਫੰਡ ਨਹੀਂ ਰਿਲੀਸ ਹੁੰਦੇ ਆ ਅਤੇ ਆਪ ਦੀ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਦਾ ਜੋ ਵੀ ਕੋਈ ਅ ਰੌਲਾ ਰੱਪਾ ਹੈਗਾ ਓ ਉਹ ਕਿ ਕੇਂਦਰ ਦੀ ਸਰਕਾਰ ਦੇ ਕਰਕੇ ਚਲਦਾ ਰਹਿੰਦਾ ਹੈ ਕਿਉਂਕਿ ਉਹ ਕਿਸਾਨਾਂ ਨੂੰ ਅ ਫੰਡ ਨਹੀਂ ਦਿੰਦੀ ਹੈ ਵਿੱਤ ਸਹਾਇਤਾ ਨਹੀਂ ਦੇ ਪਾਉਂਦੀ ਹੈ ਜਿਹਦੇ ਕਰਕੇ ਆਪਸ ਵਿੱਚ ਇਹਨਾਂ ਦੇ ਗ ਮਤਭੇਦ ਜਿਹੇ ਪਏ ਰਹਿੰਦੇ ਹਨ ਜਿਹਦੇ ਨਾਲ ਇਸ ਨਾਲ ਅ ਰਾਜ ਦੇ ਵਿਕਾਸ ਦੇ ਵਿੱਚ ਰੁਕਾਵਟ ਪਈਆਂ ਹੀ ਰਹਿੰਦੀਆਂ ਹਨ ਫਨੈਂਸ਼ਲੀ ਹੋਵੇ ਚਾਹੇ ਦੂਸਰੀਆਂ ਰਿ ਰੁਕਾਵਟਾਂ ਆਉਂਦੀਆਂ ਹੀ ਰਹਿੰਦੀਆਂ ਹਨ ਕਿਉਂ ਕਿਉਂਕਿ ਆਪਸ ਦੇ ਵਿੱਚ ਇਹਨਾਂ ਦੇ ਆਪਸ ਦੇ ਵਿੱਚ ਇਹਨਾਂ ਦੀ ਬਣਦੀ ਨਹੀਂ ਇਹਨਾਂ ਸਰਕਾਰਾਂ ਦੀ ਜਿਹਦੇ ਕਰਕੇ ਆਮ ਇਨਸਾਨ ਨੂੰ ਇੰਨੀ ਜ਼ਿਆਦਾ ਕਰੱਪਸ਼ਨ ਇੰਨੀ ਮਹਿੰਗਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਆਮ ਇਨਸਾਨ ਲਈ ਚਾਹੇ ਉਹ ਸਿਲੰਡਰ ਦੇ ਰੇਟ ਹੈ ਚਾਹੇ ਦਾਲਾਂ ਦੇ ਰੇਟ ਹਨ ਚਾਹੇ ਤੇਲ ਦੇ ਰੇਟ ਹਨ ਉਹ ਇੰਨੇ ਜ਼ਿਆਦਾ ਵੱਧ ਜਾਂਦੇ ਹਨ ਕਿ ਇੱਕ ਆਮ ਇਨਸਾਨ ਲਈ ਜੀਵਨ ਜੀਣਾ ਬਹੁਤ ਮੁਸ਼ਕਿਲ ਹੋ ਜਾਂਦਾ ਚਾਹੇ ਆਟੇ ਦੇ ਭਾਅ ਵੱਧ ਜਾਣ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਆਮ ਇਨਸਾਨ ਇਸ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ